ਭੰਗੜੇ ਦੇ ਪ੍ਰਦਰਸ਼ਨ ਲਈ ਆਮ ਪਹਿਰਾਵਾ ਰੰਗੀਨ ਜੀਵੰਤ ਅਤੇ ਡਾਂਸ ਦੀ ਸਮੁੱਚੀ ਵਿਜੂਅਲ ਅਪੀਲ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ ਪ੍ਰਦਰਸ਼ਨ ਊਰਜਾਵਾਨ ਅਤੇ ਅਨੰਦਮਈ ਸੁਭਾਅ ਨੂੰ ਪੂਰਾ ਕਰਦਾ ਹੈ ਪ ਮਰਦਾਂ ਅਤੇ ਔਰਤਾਂ ਲਈ ਰਵਾਇਤੀ ਭੰਗੜੇ ਦੇ ਪਹਿਰਾਵੇ ਥੋੜ੍ਹੇ ਵੱਖਰੇ ਹੁੰਦੇ ਹਨ ਪਰ ਦੋਵੇਂ ਬਰਾਬਰ ਪ੍ਰਭਾਵਸ਼ਾਲੀ ਹਨ ਇੱਥੇ ਆਮ ਪਹਿਰਾਵੇ 'ਤੇ ਇੱਕ ਨਜ਼ਰ ਹੈ ਅਤੇ ਇਹ ਕਿਵੇਂ ਡਾਂਸਰਾਂ ਨੂੰ ਵਧੇਰੇ ਆਕਰਸ਼ਿਤ ਬਣਾਉਂਦਾ ਹੈ ਮਰਦਾਂ ਦਾ ਪਹਿਰਾਵਾ ਨਰਦਾਂ ਦਾ ਪਹਿਰਾਵੇ ਦੇ ਪਹਿਲਾਂ ਪੱਗ ਕੁੜਤਾ ਅਤੇ ਚਾਦਰੇ ਵੇਰਵਾ ਪੱਗੜੀ ਪੱਗੜੀ ਭੰਗੜੇ ਦੇ ਪਹਿਰਾਵੇ ਦੇ ਸਭ ਤੋਂ ਮਹੱਤਵਪੂਰਨ ਤੱਤਾਂ ਵਿੱਚੋਂ ਇੱਕ ਹੈ ਇਹ ਕੀ ਆ ਆਮ ਤੌਰ 'ਤੇ ਇੱਕ ਚਮਕਦਾਰ ਰੰਗ ਦਾ ਕੱਪੜਾ ਹੁੰਦਾ ਹੈ ਇੱਕ ਖਾਸ ਸ਼ੈਲੀ ਵਿੱਚ ਬੰਨਿਆ ਜਾਂਦਾ ਹੈ ਜਿਸ ਵਿੱਚ ਕਿ ਅਕਸਰ ਇੱਕ ਪੱਖਾ ਵਰਗਾ ਟੈਂਸ਼ਨ ਹੁੰਦਾ ਹੈ ਜਿਸ ਨੂੰ ਤਰਲਾ ਕਿਹਾ ਜਾਂਦਾ ਹੈ ਪੱਗੜੀ ਡਾਂਸਰਾਂ ਲੈ ਕੇ ਉਚਾਈ ਅਤੇ ਇੱਕ ਸ਼ਾਨਦਾਰ ਦਿੱਖ ਜੋੜਦੀ ਹੈ ਜਿਸ ਨਾਲ ਉਹ ਵਧੇਰੇ ਪ੍ਰਮੁੱਖ ਅਤੇ ਆਤਮ ਵਿਸ਼ਵਾਸ ਵੀ ਦਿਖਾਈ ਦਿੰਦੇ ਹਨ ਚਮਕਦਾ ਰੰਗ ਅਤੇ ਪੱਖਾ ਇੱਕ ਗਤੀਸ਼ੀਲ ਪ੍ਰਭਾਵ ਪੈਦਾ ਕਰਦੇ ਹਨ ਜਦੋਂ ਡਾਂਸਰ ਚੱਲਦਾ ਹੈ ਤਾਂ ਬਹੁਤ ਸੋਹਣਾ ਲੱਗਦਾ ਹੈ ਕੁੜਤਾ ਇੱਕ ਲੰਮਾ ਢਿੱਲੀ ਫਿਟਿੰਗ ਆਮ ਤੌਰ 'ਤੇ ਸੂਤੀ ਜਾਂ ਰੇਸ਼ਮ ਦਾ ਬਣਿਆ ਹੁੰਦਾ ਹੈ ਜੋ ਗੋਡਿਆਂ ਤੱਕ ਪਹੁੰਚਦਾ ਹੈ ਇਹ ਚਮਕਦਾ ਰੰਗ ਦਾ ਹੁੰਦਾ ਹੈ ਇਸ ਵਿੱਚ ਕਢਾਈ ਜਾਂ ਸ਼ੀਸ਼ੇ ਦਾ ਕੰਮ ਵੀ ਹੋਇਆ ਹੁੰਦਾ ਹੈ ਕੁੜਤੇ ਦੀ ਜੀਵੰਤ ਰੰਗ ਅਤੇ ਵਿਸਤ੍ਰਿਤ ਸ਼ਿੰਗਾਰ ਰੌਸ਼ਨੀ ਨੂੰ ਫੜਦੇ ਹਨ ਅਤੇ ਡਾਂਸਰ ਨੂੰ ਵੱਖਰਾ ਬਣਾਉਂਦੇ ਹਨ ਧੰਨਵਾਦ